ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਵਿਸ਼ਾਲ ਬੋਲ ਰਿਹਾ ਜੀ ਹਾਂਜੀ ਤਰਨ ਤਰਨ ਤੋਂ ਬੋਲ ਰਿਹਾ ਜੀ ਹਾਂਜੀ ਹਾਂਜੀ ਦੇਖੋ ਮੈਂ ਤੁਹਾਨੂੰ ਇਹ ਦੱਸੂੰਗਾ ਵੀ ਚਲੋ ਜੂਨ ਦੇ ਮਹੀਨੇ ਦੇ ਵਿੱਚ ਗਰਮੀ ਤਾਂ ਬੜੀ ਹੁੰਦੀ ਆ ਪਰ ਇੱਥੇ ਜੋੜ ਮੇਲਾ ਮਨਾਇਆ ਜਾਂਦਾ ਜੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ ਜੀ ਅਤੇ ਚਲੋ ਕੋਈ ਨਹੀਂ ਉਹ ਤਾਂ ਗਰਮੀ ਤਾਂ ਹੁੰਦੀ ਪਰ ਤੁਹਾਨੂੰ ਇੱਥੇ ਰੂਮ ਪ੍ਰੋਵਾਈਡ ਕਰਵਾ ਦਾਂਗੇ ਏ ਸੀ ਰੂਮ ਆ ਹੋਟਲ ਦੇ ਵਿੱਚ ਅਤੇ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਉਸ ਮੰਨਥ ਆਉਣਾ ਨਾਲੇ ਗੁਰਦੁਆਰੇ ਹੋ ਕੇ ਜਾਣਾ ਨਾਲੇ ਮੇਲਾ ਜ਼ਰਾ ਵੇਖ ਕੇ ਜਾਣਾ ਉੱਥੇ ਹਾਂਜੀ ਹਾਂਜੀ ਹਾਂਜੀ ਇੱਥੇ ਇੱਕ ਹਾਂਜੀ ਮੰਦਰ ਨਹੀਂ ਮੰਦਰ ਵੀ ਬ ਜਿਹੜਾ ਜਨਮ ਅਸ਼ਟਮੀ ਦੇ ਟਾਈਮ 'ਤੇ ਵੀ ਆ ਸਕਦੇ ਹੋ ਤੁਸੀਂ ਸ਼ਿਵਰਾਤਰੀ ਦੇ ਟਾਈਮ 'ਤੇ ਵੀ ਆ ਸਕਦੇ ਹੋ ਬਹੁਤ ਮਤਲਬ ਕਿ ਜਿਹੜਾ ਸਾਡਾ ਸ਼ਹਿਰ ਆ ਨਾ ਬਹੁਤ ਮਨਾਇਆ ਜਾਂਦਾ ਇੱਥੇ ਹਰੇਕ ਤਿਉਹਾਰ ਨੂੰ ਬੜੇ ਅੱਛੇ ਦੇ ਨਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਲਾਗੇ ਤੁਸੀਂ ਦੇਖੋ ਇਹ ਬਿਲਕੁਲ ਸਾਡੇ ਲਾਗੇ ਇੱਕ ਅਨੰਦਪੁਰ ਸਾਡੇ ਇੱਥੇ ਬਾਬਾ ਬੁੱਢਾ ਸਾਹਿਬ ਤੁਹਾਨੂੰ ਉਹ ਵੀ ਦਰਸ਼ਨ ਕਰਾ ਸਕਦੇ ਆ ਜੀ ਅਤੇ ਇੱਥੇ ਆਪਣੇ ਗੋਇੰਦਵਾਲ ਸਾਹਿਬ ਨੇ ਤਰਨ ਤਾਰਨ ਦੇ ਲਾਗੇ ਹੀ ਆ ਜੀ ਵੀਹ ਕਿਲੋਮੀਟਰ ਦਾ ਰਸਤਾ ਵਾ ਤੁਹਾਨੂੰ ਉੱਥੇ ਵੀ ਗੁਰੂ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਮੈਮ ਠੀਕ ਆ ਜ਼ਰੂਰ ਮੈਮ ਓਕੇ ਮੈਮ ਓਕੇ ਓਕੇ ਥੈਂਕ ਯੂ ਓਕੇ ਓਕੇ